ਸਾਈਕਲ ਚਲਾਉਣਾ ਸਰੀਰ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਸਾਈਕਲ ਚਲਾਉਂਦੇ ਹੋਏ ਸਭ ਤੋਂ ਪਹਿਲਾਂ ਹਮੇਸ਼ਾ ਧਿਆਨ ਵਿੱਚ ਇਹ ਚੀਜ਼ਾਂ ਰੱਖਣੀਆਂ ਪੈਂਦੀਆਂ ਹਨ ਜਿਵੇਂ ਕਿ ਹੈਲਮੇਟ ਹੈਲਮਟ ਸਾਈਕਲ ਚਲਾਉਂਦੇ ਹੋਏ ਜ਼ਰੂਰ ਪਾਉਣਾ ਚਾਹੀਦਾ ਹੈ ਅਤੇ ਰੋਡ ਦੇ ਨਿਯਮਾਂ ਦਾ ਵੀ ਪਾਲਨ ਕਰਨਾ ਚਾਹੀਦਾ ਹੈ ਅਗਰ ਤੁਸੀਂ ਸਾਈਕਲ ਰਾਤ ਨੂੰ ਚਲਾ ਰਹੇ ਹੋ ਤੇ ਰਾਤੀ ਰਿਫਲੈਕਟਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਸਾਈਕਲ ਚਲਾਉਂਦੇ ਹੋਏ ਹਮੇਸ਼ਾ ਉਸ ਦੇ ਟਾਇਰਾਂ ਦੀ ਹਵਾ ਚੈੱਕ ਕਰ ਲੈਣੀ ਚਾਹੀਦੀ ਹੈ ਅਤੇ ਇਹ ਵੀ ਦੇਖ ਲੈਣਾ ਚਾਹੀਦਾ ਹੈ ਕਿ ਉਸਦੀ ਬ੍ਰੇਕਾਂ ਅਤੇ ਚੈਨ ਸੈਟ ਸਭ ਸਹੀ ਹਨ ਅਗਰ ਉਸ ਦੀ ਚੈਨ 'ਤੇ ਗੇਅਰ 'ਤੇ ਗਰੀਸ ਲੱਗਣ ਵਾਲੀ ਹੋਵੇ ਅਤੇ ਉਸ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਸਾਈਕਲ ਵਧੀਆ ਤਰੀਕੇ ਨਾਲ ਚੱਲਦਾ ਹੈ ਅਤੇ ਯਾਤਰਾ ਦੌਰਾਨ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਆਪਣਾ ਆਧਾਰ ਕਾਰਡ ਆਪਣੇ ਕੋਲ ਰੱਖਣਾ ਚਾਹੀਦਾ ਹੈ ਅਤੇ ਇੱਕ ਕੰਟੈਕਟ ਨੰਬਰ ਜੋ ਕਿ ਤੁਹਾਨੂੰ ਲੋੜ ਪਏ ਅਤੇ ਇਸਤੇਮਾਲ ਹੋ ਸਕੇ ਉਹ ਵੀ ਆਪਣੇ ਕੋਲ ਰੱਖਣਾ ਚਾਹੀਦਾ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਰੀਰਿਕ ਸਮੱਸਿਆ ਹੈ ਅਤੇ ਇਸ ਦੇ ਨਾਲ ਦੀ ਲੱਗਦੀ ਦਵਾਈ ਵੀ ਆਪਣੇ ਕੋਲ ਹਮੇਸ਼ਾ ਰੱਖਣੀ ਚਾਹੀਦੀ ਹੈ ਸਾਈਕਲ ਇੱਕ ਬਹੁਤ ਹੀ ਵਧੀਆ ਚੀਜ਼ ਹੈ ਇਸ ਨੂੰ ਉਪਯੋਗ ਵਿੱਚ ਲਿਆਉਣਾ ਚਾਹੀਦਾ ਹੈ